ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਹਰਮਨਦੀਪ ਸਿੰਘ ਤੁਹਾਡੇ ਲੋਕਲ ਚੈਨਲ ਤੋਂ ਗੱਲ ਕਰ ਰਿਹਾ ਹਾਂ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਵੀ ਹਾਲ ਹੀ ਦੇ ਵਿੱਚ ਹੋਈ ਤੇਜ਼ ਬਾਰਿਸ਼ ਦੇ ਕਾਰਨ ਕੀ ਤੁਹਾਡੇ ਕੋਈ ਤੁਹਾਨੂੰ ਕੀ ਕੀ ਨੁਕਸਾਨ ਸਹਿਣਾ ਪਿਆ ਕਿੰਨੀ ਮਾਰ ਤੁਹਾ ਆਪਣੇ ਇਲਾਕੇ ਦੇ ਵਿੱਚ ਹੋਈ ਹੈ ਕਿ ਤੁਸੀਂ ਉਸ ਬਾਰੇ ਸਾਨੂੰ ਕੋਈ ਜਾਣਕਾਰੀ ਦੇ ਸਕਦੇ ਹੋ

ਜੀ ਹਾਂਜੀ

ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅਤੇ ਇਸ ਦੇ ਕਾਰਨ ਕੋਈ ਤੁਹਾਡਾ ਫਸਲੀ ਨੁਕਸਾਨ ਵੀ ਹੋਇਆ ਹੈ ਜੀ ਅਤੇ ਕਿੰਨੇ ਕੁ ਮਾਰ ਪਈ ਹੈ ਇਸ ਵਾਰ ਇਸ ਝੱਖੜ ਦੇ ਕਾਰਨ ਕਿ ਉਸ ਬਾਰੇ ਕੋਈ ਦੱਸ ਸਕਦਾ

ਹਾਂਜੀ ਵੀ ਕਿੰਨੇ ਪ੍ਰਤੀਸ਼ਤ ਤੁਸੀਂ ਕਹਿ ਸਕਦੇ ਹੋ ਵੀ ਕਿੰਨੇ ਪ੍ਰਤੀਸ਼ਤ ਆ ਜਿਹੜਾ ਉਹ ਤੁਹਾ ਆਪਣੇ ਇਲਾਕੇ ਦੇ ਵਿੱਚ ਕਿੰਨੇ ਪ੍ਰਤੀਸ਼ਤ ਜਿਹੜੀ ਆਈ ਫਸਲੀ ਮਾਰ ਹੈ ਉਹ ਕਿਸਾਨਾਂ ਨੂੰ ਪਈ ਹੈ ਅੱਛਾ ਜੀ

ਠੀਕ ਹੈ ਜੀ

ਹਾਂਜੀ ਠੀਕ ਹੈ ਜੀ ਅਤੇ ਕੀ ਇਸ ਤੋਂ ਇਲਾਵਾ ਕੋਈ ਐਸੀ ਘਟਨਾ ਹੋਈ ਹੋਵੇ ਜਿਸ ਨਾਲ ਕਿਸੇ ਨੂੰ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਜਾਂ ਕੋਈ ਮਾਲੀ ਕੋਈ ਹੋ ਸਕੇ ਹੋਰ ਤਰੀਕੇ ਦਾ ਕੋਈ ਨੁਕਸਾਨ ਆਇਆ ਹੋਵੇ

ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ

ਅਤੇ ਤੁਸੀਂ ਤੁਸੀਂ ਇਸ ਬਾਰੇ ਕੀ ਸੁਝਾਅ ਦੇਣਾ ਚਾਹੁੰਦੇ ਹੈ ਕਿ ਇਸ ਤਰੀਕੇ ਦੇ ਝੱਖੜ ਦੇ ਲਈ ਜਾਂ ਇਸਦੇ ਲਈ ਵੀ ਆਪਣੀ ਜਿਹੜੀ ਸ ਸਰਕਾਰ ਹੈ ਜਾਂ ਇੱਥੋਂ ਦੀਆਂ ਆਪਣੀਆਂ ਸੰਸਥਾਵਾਂ ਨੇ ਉਹਨਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਨੇ ਤਾਂ ਕਿ ਉਹ ਇਹੋ ਜਿਹੇ ਝੱਖੜ ਦੇ ਬਾਅਦ ਲੋਕਾਂ ਦੇ ਲਈ ਕੀ ਕਿਹੇ ਕਿਸੇ ਕਿਹੜੇ ਪ੍ਰਬੰਧ ਕਰ ਸਕਦੇ ਹਨ ਤੁਹਾਡੇ ਸੁਝਾਅ ਇਸ ਬਾਰੇ ਕੀ ਹਨ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਅਸੀਂ ਇਸ ਇਹ ਜਾਣਕਾਰੀ ਤੁਹਾਡੀ ਅੱਗੇ ਤੱਕ ਜ਼ਰੂਰ ਪਹੁੰਚਾਵਾਂਗੇ ਧੰਨਵਾਦ